ਮੈਂ ਕੇਮ ਕੈਮਰੇ ਨਾਲ ਕੁਦਰਤ ਦੀਆਂ ਜਾਂ ਪੰਛੀਆਂ ਦੀਆਂ ਤਸਵੀਰਾਂ ਖਿੱਚਦਾ ਹਾਂ ਕਿਉਂਕਿ ਕੁਦਰਤ ਹਰ ਕਿਸੇ ਕੁਦਰਤ ਦੀਆਂ ਤਸਵੀਰਾਂ ਹਰ ਕਿਸੇ ਨੂੰ ਆਕਰਸ਼ਿਤ ਕਰਦੀਆਂ ਹਨ ਓਕੇ ਧੰਨਵਾਦ